ਹੈਲੋ ਹਾਂਜੀ ਹਾਂਜੀ ਹਾਂਜੀ ਬੋਲੀਏ ਕਰੋ ਕਰੋ ਪਾਓ ਪਾਓ

ਡਿਫੈਕਟਿਡ ਅੱਛਾ ਨਹੀਂ ਮਤਲਬ ਤੁਸੀਂ ਕਿਸ ਨਾਮ ਤੋਂ ਓਡਰ ਸੀਗਾ ਤੁਹਾਡਾ ਮੋਨਿਕਾ ਸਰਗੁਤਰਾ ਜਾਂ ਪਲੇਨ ਮੋਨਿਕਾ ਓਨਲੀ ਮੋਨਿਕਾ ਓਕੇ ਕਿਹੜੀ ਬੁੱਕ ਮੰਗਵਾਈ ਸੀ ਤੁਸੀਂ ਬਿਜ਼ਨਸ ਸਟੱਡੀ ਮਤਲਬ ਤੁਸੀਂ ਬਿਜ਼ਨਸ ਕਰਦੇ ਹੋ ਓਕੇ ਮੈਮ ਅਤੇ ਮਤਲਬ ਪ੍ਰੋਬਲਮ ਹੈ ਕਿ ਫਟੀ ਹੋਈ ਹੈ ਅਤੇ ਮਤਲਬ ਲੇਟ ਵੀ ਆਈ ਹੈ ਤਾਂ ਕੋਈ ਨਹੀਂ ਆਪਾਂ ਤੁਹਾਡਾ ਇਸ਼ੂ ਰਿਜੋਲਵ ਕਰ ਦਵਾਂਗੇ ਤੁਹਾਡਾ ਟਾਈਮ ਵੇਸਟ ਹੋਇਆ ਤਾਂ ਮਤਲਬ ਹੁਣ ਕੀ ਦੱਸ ਰਹੇ ਟਾਈਮ ਵਾਪਸ ਤਾਂ ਆ ਨਹੀਂ ਸਕਦਾ ਆਹ ਤਾਂ ਤੁਹਾਨੂੰ ਵੀ ਪਤਾ ਹੈ ਜੋ ਸਮਾਂ ਇੱਕ ਵਾਰ ਲੰਘ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ ਨਹੀਂ ਨਹੀਂ ਨਹੀਂ ਸਰ ਤੁਹਾਨੂੰ ਲੋੜ ਹੀ ਨਹੀਂ ਪੈਣੀ ਅੱਧੇ ਘੰਟੇ ਦੇ ਅੰਦਰ ਮਾਤਰ ਅੱਧੇ ਘੰਟੇ ਦੇ ਅੰਦਰ ਤੁਹਾਡੇ ਘਰ ਦੇ ਬਾਹਰ ਮੈਂ ਖੁਦ ਆਹ ਕਿਤਾਬਾਂ ਲੈ ਕੇ ਆਊਂਗਾ ਅਤੇ ਤੁਹਾਡਾ ਰਿਫੰਡ ਵਾਪਸ ਦਊਂਗਾ ਤੁਹਾਨੂੰ ਤੁਸੀਂ ਟੈਨਸ਼ਨ ਨਾ ਲਓ ਜੀ ਹਾਂਜੀ ਹਾਂਜੀ ਤਾਂ ਮਤਲਬ ਠੀਕ ਹੈ ਜੀ ਧੰਨਵਾਦ